ਸਤਿ ਸ਼੍ਰੀ ਅਕਾਲ ਹੋਰ ਰਾਹੁਲ ਜੀ ਬੋਲਦੇ ਹੋ ਜੀ ਰਾਹੁਲ ਜੀ ਇਹ ਆਪਣੇ ਤੁਸੀਂ ਐਂ ਕਰਨਾ ਕੱਲ੍ਹ ਤੋਂ ਸਾਰੇ ਤਾਰੀਖ ਤੁਸੀਂ ਪਹਿਲਾਂ ਸਾਰੇ ਸਕੂਲ ਚੈੱਕ ਕਰਨਾ ਜੀ ਠੀਕ ਹੈ ਹਰ ਸਕੂਲ ਦੇ ਹਰ ਟੀਚਰ ਦੇ ਟੇਬਲ 'ਤੇ ਅੱਗੇ ਇੱਕ ਗਲਾਸ ਅਤੇ ਜੱਗ ਪਾਣੀ ਦਾ ਪਿਆ ਹੋਣਾ ਚਾਹੀਦਾ ਹਾਂਜੀ ਅਤੇ ਆਪਣਾ ਤੁਸੀਂ ਹਰ ਰੋਜ਼ ਸਕੂਲ ਦੀ ਜਿੰਨੀ ਵੀ ਆਪਣੇ ਰੂਮ ਹੈਗੇ ਆ ਹਰ ਰੂਮ ਦੀ ਤੁਸੀਂ ਸਫਾਈ ਚੈੱਕ ਕਰਨੀ ਹੈ ਕੀਤੀ ਹੈ ਕਿ ਨਹੀਂ ਕੀਤੀ ਹਾਂਜੀ ਨਹੀਂ ਤੁਸੀਂ ਚੈੱਕ ਕਰਿਓ ਜੇ ਹਾਂਜੀ ਇਹ ਤੁਹਾਡੀ ਡਿਊਟੀ ਅੱਜ ਤੋਂ ਹਾਂਜੀ ਹਾਂਜੀ ਹਾਂਜੀ ਹਾਂਜੀ ਆਪਣੇ ਜਿਵੇਂ ਡਸਟਬਿਨ ਜਿੱਥੇ ਹੈ ਉਨ੍ਹਾਂ ਡਸਟਬੀਨਾਂ ਨੂੰ ਉੱਥੇ ਸੈਟ ਕਰਦਿਓ ਜੇ ਮੰਨ ਲਓ ਕੋਈ ਕਿਸੇ ਜਗ੍ਹਾ ਦੇ ਕੋਈ ਵੀ ਕਚਰਾ ਨਾ ਵਿਖੇ ਆਪਣੇ ਅਤੇ ਆਪਣੇ ਜਿਵੇਂ ਪੌਦਿਆਂ ਪੂਦਿਆਂ ਨੂੰ ਪਾਣੀ ਸਹੀ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਹਾਂਜੀ ਜੀ ਅਤੇ ਆਪਣੀ ਓ ਜਿਹੜੀ ਉਹ ਫਾਈਲਾਂ ਹੈਗੀਆਂ ਸੀ ਉਹ ਅਲਮਾਰੀ 'ਚ ਹੈਗੀਆਂ ਜਾਂ ਚੈ ਹੋਰ ਕਿਤੇ ਰੱਖੀਆਂ ਹੋਣ

ਹਾਂਜੀ ਹਾਂਜੀ ਇਹ ਆਪਣੇ ਜਿਹੜੇ ਓਫ ਸਕੂਲ ਦਾ ਰੂਮ ਨੰਬਰ ਗਿਆਰਾਂ ਦਾ ਜਿਹੜਾ ਸੀ ਪੱਖਾ ਸੈਟ ਕਰਵਾ ਲਿਆ ਜੀ ਹਜੇ ਨਹੀਂ ਕਰਵਾਇਆ ਹਾਂਜੀ ਕੀ ਕੀ ਪ੍ਰੋਬਲਮ ਸੀ ਹਾਂਜੀ ਅਤੇ ਆਪਣੇ ਜਿਹੜਾ ਦਫ਼ ਆਪਣਾ ਆਫਿਸ ਦਾ ਜਿਹੜਾ ਕੰਪਿਊਟਰ ਸੀ ਉਹਦੇ 'ਚ ਪ੍ਰੋਬਲਮ ਆ ਰਹੀ ਸੀ ਉਹਦੇ ਕੋਈ ਵਿਖਾਇਆ ਨਹੀਂ ਵਿਖਾਇਆ ਹਜੇ ਤੱਕ ਹਾਂਜੀ ਹਾਂਜੀ ਅਤੇ ਆਪਣੇ ਨਾ ਇੱਕ ਕੀ ਨਾਮ ਹੈ ਗਰਾਊਂਡ 'ਚ ਥੋੜ੍ਹੀ ਜੀ ਹੈ ਪ੍ਰੋਬਲਮ ਆ ਰਹੀ ਕਈ ਜਗ੍ਹਾ ਦੇ ਵਿੱਚ ਹਾਂ ਹਾਂਜੀ ਹਾਂਜੀ ਅਤੇ ਉਹਦੇ ਵਿੱਚ ਜਿਵੇਂ ਵਿੱਚ ਥੋੜ੍ਹੇ ਬਹੁਤ ਖੱਡੇ ਹੈ ਕੋਈ ਵਿੱਚ ਜਿਵੇਂ ਕੋਈ ਖੇਡਦਾ ਤਾਂ ਉਹਨਾਂ ਨੇ ਕੋਈ ਚੋਟ ਨਾ ਲੱਗ ਜਾਵੇ ਖੱਡੇ ਭਰਵਾ ਦੇਵੋ ਹਾਂਜੀ ਅਤੇ ਗਰਾਊਂਡ ਦੇ ਆਪਣੇ ਥੋੜ੍ਹੇ ਬਹੁਤ ਪੌਦੇ ਲਗਵਾਉਣ ਵਾਲੇ ਸਾਈਡ 'ਤੇ ਪੌਦੇ ਨਹੀਂ ਲੱਗੇ ਹੋਏ ਹਾਂਜੀ ਹਾਂਜੀ ਠੀਕ ਹੈ ਫਿਰ ਤੁਸੀਂ ਕੰਮ ਕਰਵਾਉਣਾ ਜ਼ਰੂਰੀ ਕੱਲ੍ਹ ਓਕੇ ਥੈਂਕ ਯੂ ਰਾਹੁਲ ਤੁਸੀਂ ਜਿੰਮੇਵਾਰੀ ਲਈ ਥੈਂਕ ਯੂ